ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਇੱਥੇ ਕਾਫੀ ਸਾਰੇ ਸਮਾਗਮ ਤੁਹਾਨੂੰ ਪੰਜਾਬ ਦੇ ਨਾਮ 'ਤੇ ਪਤਾ ਲੱਗ ਕਿਉਂਕਿ ਪੰਜਾਬ ਵਿੱਚ ਮੇਲੇ ਅਤੇ ਤਿਉਹਾਰ ਆਉਂਦੇ ਜਾਂਦੇ ਰਹਿੰਦੇ ਨੇ ਅਤੇ ਹਰੇਕ ਤਿਉਹਾਰ ਜਾਂ ਸਮਾਗਮ 'ਤੇ ਲੋਕ ਭੰਗੜਾ ਜਾਂ ਗਿੱਧਾ ਪਾਉਣਾ ਬਹੁਤ ਪਸੰਦ ਕਰਦੇ ਨੇ ਭੰਗੜਾ ਜਿਹੜਾ ਹੈ ਮਰਦਾਂ ਦਾ ਲੋਕ ਨਾਚ ਹੈ ਅਤੇ ਜਿਹੜਾ ਗਿੱਧਾ ਹੈ ਉਹ ਔਰਤਾਂ ਦਾ ਲੋਕ ਨਾਚ ਹੈ ਅਤੇ ਇਹਨੂੰ ਆਪਣੀ ਖੁਸ਼ੀ ਨੂੰ ਪ੍ਰਗਟਾਉਣ ਲਈ ਪਿੰਡ ਦੀਆਂ ਬੁੜੀਆਂ ਅਤੇ ਔਰਤਾਂ ਕਾਫੀ ਸਾਰੇ ਸਮਾਗਮਾਂ 'ਤੇ ਅਤੇ ਕਾਫੀ ਸਾਰੇ ਤਿਉਹਾਰਾਂ 'ਤੇ ਕਿਸੇ ਦੇ ਵਿਆਹ ਦੇ ਸਮਾਗਮ 'ਤੇ ਇਹ ਗਿੱਧਾ ਪਾਉਣਾ ਬਹੁਤ ਹੀ ਪਸੰਦ ਕਰਦੇ ਨੇਗੇ ਗਿੱਧਾ ਇਹਨਾਂ ਦੇ ਹਾਵ ਭਾਵ ਨੂੰ ਵੀ ਬਹੁਤ ਜ ਵਧੀਆ ਤਰੀਕੇ ਨਾਲ ਪ੍ਰਗਟ ਕਰਦਾ ਇਹ ਹਰੇਕ ਤਿਉਹਾਰ 'ਤੇ ਇਹ ਗਿੱਧਾ ਜਾਂ ਭੰਗੜਾ ਕਰਦੇ ਨੇਗੇ ਏ ਪੰਜਾਬ ਵਿੱਚ ਇਹ ਕਾਫੀ ਸਾਰੇ ਪਿੰਡਾਂ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਉਹਨਾਂ ਨੂੰ ਇਸ ਤੋਂ ਬਿਨਾਂ ਤਿਉਹਾਰ ਅਧੂਰਾ ਜਾ ਹੀ ਲੱਗਦਾ ਹੈ